ਨਮਸਕਾਰ ਜੀ ਮੈਂ ਸ਼ਾਮ ਲਾਲ ਗੱਲ ਕਰ ਰਿਹਾ ਹਾਂ ਮੈਂ ਮਿਤੀ ਇੱਕ ਨਵੰਬਰ ਦੋ ਹਜ਼ਾਰ ਚੌਵੀ ਨੂੰ ਫ਼ਜ਼ਿਲਕਾ ਤੋਂ ਮੁੰਬਈ ਸੈਂਟਰਲ ਸ਼ਤਾਬਦੀ ਐਕਸਪ੍ਰੈਕਸ ਰਾਹੀਂ ਜਾਣਾ ਚਾਹੁੰਦਾ ਹਾਂ ਇਸ ਲਈ ਮੈਂ ਟਿਕੇਟ ਬੁੱਕ ਕਰਵਾਉਣੀ ਸੀ ਕੀ ਤੁਸੀਂ ਮੇਰੀ ਟਿਕਟ ਬੁੱਕ ਕਰਵਾਉਣ ਵਿੱਚ ਮਦਦ ਕਰ ਸਕਦੇ ਹੋ ਮੇਰੀ ਆਈ ਆਰ ਸੀ ਟੀ ਸੀ ਯੂਜ਼ਰ ਆਈ ਡੀ ਅਤੇ ਪਾਸਵਰਡ ਲਗਾ ਕੇ ਮੈਂ ਆਪਣੇ ਕੰਪਿਊਟਰ ਵਿੱਚ ਲੋਗਇਨ ਕਰ ਲਿਆ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਅਲੱਗ ਅਲੱਗ ਕਲਾਸਾਂ ਬਾਰੇ ਦੱਸੋ ਅਤੇ ਇਸ ਦਾ ਆਨਲਾਈਨ ਭੁਗਤਾਨ ਕਿਸ ਤਰ੍ਹਾਂ ਕਰਨਾ ਹੈ ਉਸ ਬਾਰੇ ਮੇਰੀ ਮਦਦ ਕਰੋ ਜੀ